ਅੱਜ ਮੈਂ ਗੱਲ ਕਰਾਂਗੀ ਪੰਜਾਬੀਆਂ ਦੇ ਪਹਿਰਾਵੇ ਬਾਰੇ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਗਿੱਧਾ ਇੱਕ ਰਵਾਇਤੀ ਪੰਜਾਬੀ ਨਾਚ ਰੂਪ ਜੋ ਔਰਤਾਂ ਦੁਆਰਾ ਪੇਸ਼ ਕੀਤਾ ਜਾਂਦਾ ਹੈ ਇੱਕ ਸ਼ਾਨਦਾਰ ਪਹਿਰਾਵੇ ਦੇ ਨਾਲ ਹੀ ਹੁੰਦਾ ਹੈ ਗਿੱਧੇ ਦੇ ਪਹਿਰਾਵੇ ਵਿੱਚ ਆਮ ਤੌਰ 'ਤੇ ਰੰਗੀਨ ਸਵਾ ਸਲਵਾਰ ਕਮੀਜ਼ ਕਈ ਤਰ੍ਹਾਂ ਦੇ ਦੁਪੱਟੇ ਦੇ ਨਾਲ ਲਹਿੰਗਾ ਕੁੜਤੀ ਸ਼ਾਮਲ ਹੁੰਦੀ ਹੈ ਜੋ ਪੰਜਾਬੀ ਔਰਤਾਂ ਦੀ ਸੁੰਦਰਤਾ ਨੂੰ ਦਰਸਾਉਂਦੀ ਹੈ ਫੁਲਕਾਰੀ ਸੂਟ ਪੰਜਾਬੀ ਕਢਾਈ ਦਾ ਇੱਕ ਸ਼ਾਨਦਾਰ ਨਮੂਨਾ ਹੈ ਜਿਸ ਵਿੱਚ ਰੰਗੀਨ ਧਾਗਿਆਂ ਨਾਲ ਸਿਲੇ ਹੋਏ ਫੁੱਲਦਾਰ ਨਮੂਨੇ ਹਨ ਗੁੰਝਲਦਾਰ ਕਢਾਈ ਵਾਲਾ ਦੁਪੱਟਾ ਅਤੇ ਕੁੜਤੀ ਇਸ ਰਵਾਇਤੀ ਪਹਿਰਾਵੇ ਨੂੰ ਕਾਰੀਗਰੀ ਅਤੇ ਸੱਭਿਆਚਾਰ ਅਮੀਰੀ ਦਾ ਪ੍ਰਤੀਕ ਬਣਾਉਂਦੇ ਹਨ ਤੁਸੀਂ ਸਦਾ ਪਿੰਡ ਵਿਖੇ ਰਵਾਇਤੀ ਫੁਲਕਾਰੀ ਬਣਾਉਣ ਲਈ ਦੇਖ ਸਕਦੇ ਹੋ ਖਰੀਦ ਸਕਦੇ ਹੋ ਅਤੇ ਇੱਥੋਂ ਤੱਕ ਕਿ ਆਪਣਾ ਹੱਥ ਅਜ਼ਮਾ ਸਕਦੇ ਹੋ ਪਟਿਆਲਾ ਰਿਆਸਤ ਤੋਂ ਸ਼ੁਰੂ ਹੋਏ ਇਸ ਰਵਾਇਤੀ ਪਹਿਰਾਵੇ ਵਿੱਚ ਇੱਕ ਛੋਟੀ ਕੁੜਤੀ ਅਤੇ ਇੱਕ ਵਹਿੰਦਾ ਦੁਪੱਟਾ ਸ਼ਾਮਲ ਹੁੰਦਾ ਹੈ ਕੁੜੀਆਂ ਗਲਾਂ ਵਿੱਚ ਰਾਣੀਹਾਰ ਸਿਰ ਉੱਤੇ ਸੱਗੀ ਫੁੱਲ ਕੰਨਾਂ ਵਿੱਚ ਝੁਮਕੇ ਪਿੱਪਲ ਪੱਤੀਆਂ ਆਦਿ ਬਹੁਤ ਸ ਤਰ੍ਹਾਂ ਦੇ ਗਹਿਣੇ ਪਹਿਨਦੀਆਂ ਹਨ ਪਟਿਆਲਾ ਸ਼ਾਹੀ ਸਲਵਾਰ ਸੂਟ ਆਪਣੀ ਸ਼ਾਹੀ ਦਿੱਖ ਅਤੇ ਆਰਾਮ ਲਈ ਜਾਣਿਆ ਜਾਂਦਾ ਹੈ ਇਸ ਨੂੰ ਵੱਖ ਵੱਖ ਮੌਕਿਆਂ ਲਈ ਇੱਕ ਪ੍ਰਸਿੱਧ ਵਿਕਲਪ ਬਣਾਉਂਦਾ ਹੈ ਅੱਜ ਪਟਿਆਲਾ ਸ਼ਾਹੀ ਇਕ ਸਦੀਵੀ ਟੁਕੜਾ ਹੈ ਜੋ ਹਰ ਉਮਰ ਦੀਆਂ ਔਰਤਾਂ ਦੁਆਰਾ ਇਸਦੀ ਬਹੁਪੱਖੀਤਾ ਅਤੇ ਸ਼ਾਨਦਾਰ ਸਹਿਜ ਲਈ ਪਿਆਰੀ ਹੈ ਪਠਾਣੀ ਸੂਟ ਪਠਾਨ ਸੱਭਿਆਚਾਰ ਤੋਂ ਸ਼ੁਰੂ ਹੋਇਆ ਇੱਕ ਪਿਆਰਾ ਪੰਜਾਬੀ ਪਹਿਰਾਵਾ ਹੈ ਸਲਵਾਰ ਜਾਂ ਚੂੜੀਦਾਰ ਦੇ ਨਾਲ ਇੱਕ ਲੰਬੇ ਸਿੱਧੇ ਕੱਟ ਕੁੜਤੇ ਨੂੰ ਸ਼ਾਮਲ ਕਰਦੇ ਹੋਏ ਇਹ ਆਰਾਮ ਅਤੇ ਸ਼ੈਲੀ ਪ੍ਰਦਾਨ ਕਰਦਾ ਹੈ ਅਕਸਰ ਘੱਟੋ ਘੱਟ ਕਢਾਈ ਨਾਲ ਸ਼ਿੰਗਾਰਿਆ ਜਾਂਦਾ ਹੈ ਅਤੇ ਸਾਹਮਣੇ ਬਟਨ ਵਾਲੇ ਪਲੇਕੇਟ ਦੀ ਵਿਸ਼ੇਸ਼ਤਾ ਰੱਖਦਾ ਹੈ ਪਠਾਣੀ ਸੂਟ ਆਪਣੀ ਸਾਦਗੀ ਅਤੇ ਬਹੁਪੱਖੀਤਾ ਲਈ ਜਾਣਿਆ ਜਾਂਦਾ ਹੈ ਇਹ ਵੱਖ ਵੱਖ ਮੌਕਿਆਂ ਲਈ ਪੰਜਾਬੀ ਮਰਦਾਂ ਵਿੱਚ ਇੱਕ ਪ੍ਰਸਿੱਧ ਚੋਣ ਹੈ ਜੋ ਸੱਭਿਆਚਾਰਕ ਵਿਰਾਸਤ ਅਤੇ ਸਦੀਵੀ ਸੁੰਦਰਤਾ ਨੂੰ ਦਰਸਾਉਂਦੀ ਹੈ ਪੰਜਾਬੀ ਮਰਦਾਂ ਲਈ ਪੱਗ ਸਿਰਫ ਇੱਕ ਸਹਾਇਕ ਉਪਕਰਨ ਨਹੀਂ ਹੈ ਸਗੋਂ ਇੱਕ ਤਾਜ ਹੈ ਜੋ ਸਨਮਾਨ ਮਾਨ ਅਤੇ ਮਾਨ ਦਾ ਪ੍ਰਤੀਕ ਹੈ ਦਸਤਾਰ ਦੀ ਸ਼ੈਲੀ ਰੰਗ ਅਤੇ ਫੈਬਰਿਕ ਕਿਸੇ ਵਿਅਕਤੀ ਬਾਰੇ ਉਸਦੇ ਜੱਦੀ ਸ਼ਹਿਰ ਤੋਂ ਲੈ ਕੇ ਉਸਦੇ ਕਿੱਤੇ ਤੱਕ ਬਹੁਤ ਸਾਰੀ ਜਾਣਕਾਰੀ ਪ੍ਰਦਾਨ ਕਰ ਸਕਦਾ ਹੈ ਪਗੜੀ ਜਿਵੇਂ ਕਿ ਇਸ ਨੂੰ ਸਥਾਨਕ ਤੌਰ 'ਤੇ ਜਾਣਿਆ ਜਾਂਦਾ ਹੈ ਗੁੰਝਲਦਾਰ ਢੰਗ ਨਾਲ ਬੰਨਿਆ ਹੋਇਆ ਹੈ ਅਤੇ ਇਸ ਦੇ ਡਿਜ਼ਾਇਨ ਵਿੱਚ ਭਿੰਨਤਾਵਾਂ ਰਵਾਇਤੀ ਪੰਜਾਬੀ ਸੱਭਿਆਚਾਰ ਦੇ ਪਹਿਰਾਵੇ ਵਿੱਚ ਵਿਭਿੰਨਤਾ ਦਾ ਪ੍ਰਮਾਣ ਹਨ ਤੰਬਾ ਜਿਸਨੂੰ ਤਹਿਮਤ ਵੀ ਕਿਹਾ ਜਾਂਦਾ ਹੈ ਲੂੰਗੀ ਦਾ ਪੰਜਾਬੀ ਰੂਪ ਹੈ ਇਸ ਵਿੱਚ ਮੂਹਰਲੇ ਪਾਸੇ ਫੋਲਡ ਹਨ ਅਤੇ ਇਹ ਪੰਜਾਬੀ ਮਰਦਾਂ ਲਈ ਇੱਕ ਪ੍ਰਸਿੱਧ ਰਵਾਇਤੀ ਪਹਿਰਾਵਾ ਹੈ ਖ਼ਾਸ ਕਰਕੇ ਭੰਗੜਾ ਡਾਂਸਰਾਂ ਦੁਆਰਾ ਪਹਿਨਿਆ ਜਾਂਦਾ ਹੈ ਇਸ ਦੀ ਵਿਲੱਖਣ ਸ਼ੈਲੀ ਭੰਗੜਾ ਨਾਮ ਉਸਾਰਣ ਦੇ ਗਤੀਸ਼ੀਲ ਅਤੇ ਊਰਜਾਵਾਨ ਤੱਤ ਨੂੰ ਜੋੜਦੀ ਹੈ ਪੰਜਾਬੀ ਵਿਆਹ ਇੱਕ ਅਜਿਹਾ ਜਸ਼ਨ ਹੈ ਜਿਵੇਂ ਕਿ ਕੋਈ ਹੋਰ ਨਹੀਂ ਅਤੇ ਦੁਲਹਨ ਦਾ ਪਹਿਰਾਵਾ ਕਿਸੇ ਸ਼ਾਨਦਾਰ ਤਮਾਸ਼ੇ ਤੋਂ ਘੱਟ ਨਹੀਂ ਹੈ ਲਾੜੀ ਨੂੰ ਇੱਕ ਸ਼ਾਨਦਾਰ ਲਹਿੰਗਾ ਚੋਲੀ ਵਿੱਚ ਸ਼ਿੰਗਾਰਿਆ ਜਾਂਦਾ ਹੈ ਜੋ ਅਕਸਰ ਗੁੰਝਲਦਾਰ ਕਢਾਈ ਕੁਈਨ ਅਤੇ ਸ਼ੀਸ਼ੇ ਦੇ ਕੰਮ ਨਾਲ ਸ਼ਿੰਗਾਰਿਆ ਜਾਂਦਾ ਹੈ ਪਰੰਪਰਾਗਤ ਨਾ ਲਾਲ ਅਤੇ ਮੈਹਰੂਨ ਰੰਗ ਸ਼ੁਭ ਅਤੇ ਖੁਸ਼ਹਾਲੀ ਦਾ ਪ੍ਰਤੀਕ ਹਨ ਜਦੋਂ ਕਿ ਦੁਲਹਨ ਦੇ ਗੁੱਟ ਤੋਂ ਲਟਕਦੇ ਕਲੀਰੇ ਪਰੰਪਰਾ ਅਤੇ ਲੋਕਧਾਰਾ ਨੂੰ ਜੋੜਦੇ ਹਨ